ਜਿਵੇਂ ਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਸਾਡੇ ਘਰ ਵਿੱਚ ਸਾਰੇ ਪੜ੍ਹੇ ਲਿਖੇ ਹਨ ਅਤੇ ਉਹ ਬਹੁਤ ਸਾਰੀਆਂ ਕਿਤਾਬਾਂ ਲੈ ਕੇ ਆਉਂਦੇ ਰਹਿੰਦੇ ਹਨ ਅਤੇ ਪੜ੍ਹਦੇ ਹਨ ਉਹਨਾਂ ਵਿੱਚੋਂ ਮੈਂ ਵੀ ਕੁਝ ਕਿਤਾਬਾਂ ਪੜ੍ਹਦਾ ਹਾਂ ਉਹਨਾਂ ਵਿੱਚੋਂ ਇੱਕ ਕਿਤਾਬ ਨਰਿੰਦਰ ਕਪੂਰ ਦੀ ਹੈ ਵੈਸੇ ਤਾਂ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਬਹੁਤ ਵਧੀਆ ਹਨ ਉਹਨਾਂ ਵਿੱਚੋਂ ਇੱਕ ਕਿਤਾਬ ਖਿੜਕੀਆਂ ਮੈਨੂੰ ਬਹੁਤ ਵਧੀਆ ਲੱਗਦੀ ਆ ਉਸ ਦਾ ਕੁਝ ਕਿੱਸਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਵੇਂ ਜੋ ਸਾਡੇ ਲਈ ਅਸੰਭਵ ਹੁੰਦਾ ਹੈ ਉਸ ਨੂੰ ਸਾਡੇ ਬੱਚੇ ਸੰਭਵ ਕਰ ਦਿਖਾਉਂਦੇ ਹਨ ਬੱਚਿਆਂ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦੀ ਹਿੰਮਤ ਬੀਜੋ ਜੇ ਬੱਚਿਆਂ ਦੀ ਆਲੋਚਨਾ ਹੀ ਕਰਦੇ ਰਹੋਗੇ ਉਹ ਸਾਰਾ ਜੀਵਨ ਹੋਰਾਂ ਨੂੰ ਭੰਡਣ ਵਿੱਚ ਹੀ ਲਗਾ ਦੇਣਗੇ ਜੇ ਉਹਨਾਂ ਦੀਆਂ ਸੁਭਾਵਿਕ ਭਾਵਨਾਵਾਂ ਦਾ ਵਿਰੋਧ ਕਰੋਗੇ ਉਹ ਹਿੰਸਕ ਅਤੇ ਲੜਾਕੇ ਹੋ ਨਿਬੜਣਗੇ ਜੇ ਉਹਨਾਂ ਨੂੰ ਡਰ ਪਾਓਗੇ ਉਹ ਹਰ ਚੀਜ਼ ਤੋਂ ਡਰਨਗੇ ਜੇ ਉਹਨਾਂ 'ਤੇ ਤਰਸ ਕਰੋਗੇ ਅਤੇ ਹਰ ਥਾਂ ਸਹਾਰਾ ਬਣੋਗੇ ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਢੇਰੀ ਢਾਹ ਬੈਠਣਗੇ ਜੇ ਉਹਨਾਂ ਦਾ ਮਖੌਲ ਉਡਾਓਗੇ ਉਹ ਲੁਕਣ ਲੱਗ ਜਾਣਗੇ ਜੇ ਉਹਨਾਂ ਵਿੱਚੋਂ ਈਰਖਾ ਸਾੜਾ ਨਹੀਂ ਕੱਢੋਗੇ ਉਹ ਹੀਣ ਭਾਵਨਾ ਤੋਂ ਕਦੇ ਮੁਕਤ ਨਹੀਂ ਹੋ ਸਕ ਹੋਣਗੇ ਜੇ ਉਹਨਾਂ ਨੂੰ ਸ਼ਰਮਸਾਰ ਕਰੋ ਕਰਦੇ ਰਹੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸੰਕਰ੍ਰਿਣਨ ਹੋ ਜਾਵੇਗਾ ਜੋ ਉਹਨਾਂ ਵਿੱਚ ਨੁਕਸਾਨ ਹੀ ਕੱਢਦੇ ਰਹੋਗੇ ਤਾਂ ਉਹ ਨਵਾਂ ਨਹੀਂ ਸ ਕਰ ਸਕਣਗੇ ਪਰ ਜੇ ਉਹਨਾਂ ਨਾਲ ਸਬਰ ਨਾਲ ਪੇਸ਼ ਆਓਗੇ ਤਾਂ ਉਹ ਧੀਰਜਵਾਨ ਬਣ ਜਾਣਗੇ ਜੇ ਉਹਨਾਂ ਵਿੱਚ ਸਵੈ ਵਿਸ਼ਵਾਸ ਭਰੋਗੇ ਤਾਂ ਉਹ ਹਰ ਮੁਸ਼ਕਲ ਨੂੰ ਹੱਲ ਕਰ ਵਿਖਾਉਣਗੇ ਜੇ ਉਹਨਾਂ ਦੇ ਚੰਗੇ ਕਰਮਾਂ ਦੀ ਸਿਫਤ ਕਰੋਗੇ ਤਾਂ ਉਹਨਾਂ ਵਿੱਚ ਦੂਜਿਆਂ ਨੂੰ ਸਹਿਲਾਉਣ ਦੀ ਦਲੇਰੀ ਉਪਜੇਗੀ ਜੇ ਉਹਨਾਂ ਨੂੰ ਜਿਵੇਂ ਉਹ ਪ੍ਰਵਾਨ ਕਰੋਗੇ ਉਹਨਾਂ ਨੂੰ ਹਰ ਕਿਸੇ ਨਾਲ ਰਹਿਣ ਦੀ ਜਾਂਚ ਆ ਜਾਵੇਗੀ ਜੇ ਉਹਨਾਂ ਦੇ ਗੁਣਾਂ ਨਾਲ ਦੋਸ਼ਾਂ ਨੂੰ ਵੀ ਸਵੀਕਾਰ ਕਰੋਗੇ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ ਜੇ ਉਹਨਾਂ ਦੀ ਨੂੰ ਇਮਾਨਦਾਰ ਅਤੇ ਵਫਾਦਾਰੀ ਸਿਖਾਓਗੇ ਤਾਂ ਉਹ ਸੱਚ ਅਤੇ ਇਨਸਾਫ ਦੇ ਲਈ ਦੇ ਪਹਿਰੇਦਾਰ ਬਣ ਜਾਣਗੇ ਜੇ ਉਹਨਾਂ ਵਿੱਚੋਂ ਸੁਰੱਖਿਆ ਅਤੇ ਸੁਤੰਤਰਤਾ ਦੀ ਭਾਵਨਾ ਜਗਾਓਗੇ ਤਾਂ ਉਹਨਾਂ ਵਿੱਚ ਦੂਜਿਆਂ ਦਾ ਧਿਆਨ ਰੱਖਣ ਦੀ ਅਮੀਰੀ ਜਾਗੇਗੀ ਜੋ ਉਹਨਾਂ ਨੂੰ ਆਪਣੀ ਮਾਂ ਦੀਆਂ ਆਸਾਂ ਦੀ ਜਾਗ ਲਾਉਂਦੇ ਰਹੋਗੇ ਉਹ ਪਰਿਵਾਰ ਸਮਾਜ ਅਤੇ ਦੇਸ਼ ਵਿੱਚ ਮਹਿਮਾ ਕਮਾਉਣਗੇ ਜਿਵੇਂ ਠੀਕ ਲੱਗੇ ਉਵੇਂ ਕਰਨਾ ਪਰ ਇੱਕ ਵਿਦਿਆਰਥੀ ਨੇਤਰਹੀਣ ਸੀ ਪਰ ਬ ਗਾਉਂਦਾ ਬਹੁਤ ਚੰਗਾ ਸੀ ਉਸ ਦੇ ਗਾਉਣ ਦੀਆਂ ਧੂਮਾਂ ਪਈਆਂ ਹੋਈਆਂ ਸਨ ਉਸਦੀ ਇੱਕ ਜਮਾਤਣ ਨੇ ਉਸ ਨੂੰ ਬੜਾ ਪਿਆਰ ਕੀਤਾ ਅਤੇ ਉਸ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕੀਤੀ ਉਸ ਵਿਦਿਆਰਥੀ ਨੇ ਕਿਹਾ ਵਿਆਹ ਤਾਂ ਮੈਂ ਤਾਂ ਹੀ ਕਰਵਾਊਂਗਾ ਜਦੋਂ ਮੈਂ ਅੱਖਾਂ ਨਾਲ ਵੇਖਣ ਲੱਗ ਪਵਾਂਗਾ ਉਸ ਨੂੰ ਦਾਨ ਕੀਤੀ ਅੱਖਾਂ ਨਾਲ ਦਿਸਣ ਲੱਗ ਪਿਆ ਪਰ ਉਹ ਇਹ ਵੇਖ ਕੇ ਪਰੇਸ਼ਾਨ ਸੀ ਕਿ ਉਸਦੀ ਪ੍ਰੇਮਿਕਾ ਅੰਨ੍ਹੀ ਸੀ ਜਦੋ ਪ੍ਰੇਮਿਕਾ ਨੇ ਉਸਨੂੰ ਵਿਆਹ ਦੀ ਲਾਈ ਸ਼ਰਤ ਦੇ ਪੂਰੀ ਹੋਣ 'ਤੇ ਵਿਆਹ ਕਰਵਾਉਣ ਲਈ ਕਿਹਾ ਤਾਂ ਉਸ ਨੇ ਵਿਆਹ ਕਰਾਵਾਉਣ ਤੋਂ ਇਨਕਾਰ ਕਰ ਦਿੱਤਾ